ਬਹੁਤ ਸਾਰੇ ਧਾਰਮਿਕ ਸਥਾਨ ਹੁੰਦੇ ਹਨ ਜਿਵੇਂ ਕਿ ਗੁਰਦੁਆਰਾ ਸਾਹਿਬ ਮੰਦਰ ਚਰਚ ਦਰਗਾਹ ਮਸਜਿਦ ਡੇਰੇ ਅਤੇ ਪਰ ਜਿਹੜੇ ਲੋਕ ਹੁੰਦੇ ਆ ਉਹਨਾਂ ਦਾ ਆਪਦੇ ਆਪਦੇ ਧਰਮਾਂ ਅਨੁਸਾਰ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਆਪਦਾ ਆਪਦਾ ਵਿਸ਼ਵਾਸ ਹੁੰਦਾ ਜਿਵੇਂ ਕਿ ਜਿਹੜੇ ਸਿੱਖ ਲੋਕ ਆ ਉਹ ਗੁਰਦੁਆਰਿਆਂ 'ਚ ਜਾਣਾ ਪਸੰਦ ਕਰਦੇ ਹਨ ਉੱਥੇ ਜਾ ਕੇ ਉਹ ਗੁਟਕਾ ਸਾਹਿਬ ਪੜ੍ਹਦੇ ਹਨ ਹੋਰ ਉੱਥੇ ਲੰ ਲੰਗਰ ਦੀ ਸੇਵਾ ਵਰਤਾਉਂਦੇ ਹਨ ਆਪਦਾ ਆਪਦਾ ਵੱਖੋ ਵੱਖਰਾ ਢੰਗ ਹੁੰਦਾ ਜਿਵੇਂ ਮੰਦਰ 'ਚ ਜਦੋਂ ਜਾਂਦੇ ਹਨ ਹਿੰਦੂ ਲੋਕ ਉੱਥੇ ਉਹ ਜਾ ਕੇ ਮੂਰਤੀ ਦੀ ਪੂਜਾ ਕਰਦੇ ਹਨ ਭਗਵਾਨ ਨੂੰ ਪੂਜਦੇ ਹਨ ਉੱਥੇ ਉਹਨਾਂ ਦੀ ਸੇਵਾ ਕਰਦੇ ਹਨ ਆਰਤੀ ਵੀ ਕਰਦੇ ਹਨ ਅਤੇ ਫਿਰ ਕੀਰਤਨ ਵੀ ਹੁੰਦੇ ਹਨ ਉੱਥੇ ਅਤੇ ਜਿਹੜੇ ਮੁਸਲਿਮ ਲੋਕ ਹੁੰਦੇ ਆ ਉਹ ਦਰਗਾਹ ਵਿੱਚ ਜਾਣਾ ਪਸੰਦ ਕਰਦੇ ਹਨ ਉੱਥੇ ਜਾ ਕੇ ਆਪਦਾ ਕੁਰਾਨ ਪੜ੍ਹਦੇ ਹਨ ਅੱਲਾਹ ਨੂੰ ਯਾਦ ਕਰਦੇ ਹਨ ਫਿਰ ਚਰਚ ਜਿਹੜੇ ਜਿਵੇਂ ਇਸਾਈ ਲੋਕ ਹੁੰਦੇ ਹਨ ਉਹ ਚਰਚ ਵਿੱਚ ਜਾਣਾ ਪਸੰਦ ਕਰਦੇ ਹਨ ਉੱਥੇ ਜਾ ਕੇ ਬਾਈਬਲ ਪ ਪੜ੍ਹਦੇ ਹਨ ਹਰੇਕ ਐਤਵਾਰ ਨੂੰ ਜਾ ਕੇ ਉਹ ਉੱਥੇ ਆਪਦੀ ਪ੍ਰੇਅਰ ਪੂਰੀ ਕਰਦੇ ਹਨ ਕਾਫੀ ਜਾਣਿਆਂ ਨੂੰ ਡੇਰੇ ਵਿੱਚ ਜਾਣਾ ਵੀ ਪਸੰਦ ਹੁੰਦਾ ਉੱਥੇ ਸੇਵਾ ਵਰਤਾਉਣੀ ਵੀ ਪਸੰਦ ਹੁੰਦੀ ਹੈ ਅਤੇ ਹੋਰ ਵੀ ਕੀ ਕਹਿੰਦੇ ਕੀਰਤਨ ਕਰਨੇ ਵੀ ਪਸੰਦ ਹੁੰਦੇ ਹੈ ਸ ਸਭ ਦਾ ਵੱਖੋ ਵੱਖਰਾ ਢੰਗ ਹੁੰਦਾ ਪਰ ਸਾਡੇ ਮੰਨਣੀ 'ਚ ਇਹੀ ਹੈ ਕਿ ਰੱਬ ਸਿਰਫ ਇੱਕ ਹੀ ਹੁੰਦਾ ਪਰ ਲੋਕਾਂ ਨੇ ਆਪਦੇ ਧਰਮ ਅਨੁਸਾਰ ਉਹਨਾਂ ਉਹ ਰੱਬ ਨੂੰ ਅਪਣਾਇਆ ਹੋਇਆ ਤਾਂ ਇਸ ਲਈ ਰੱਬ ਇੱਕ ਹੀ ਹੁੰਦਾ ਤਾਂ ਇੱਕ ਨੂੰ ਹੀ ਮੰਨਣਾ ਚਾਹੀਦਾ ਹੈ